ਹੈਲੋ ਹੈਲੋ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਲਾਈਕ ਆਏ ਮਤਲਬ ਮੈਂ ਪ੍ਰੈਫਰ ਕਰ ਰਹੀ ਹਾਂ ਕਿ ਤੁਹਾਨੂੰ ਤੁਹਾਨੂੰ ਸੀ ਕੇ ਡੀ ਕੋਲਜ ਜਾਣਾ ਚਾਹੀਦਾ ਹੈ ਹੋਰ ਵੀ ਕਾਫੀ ਸਾਰੇ ਕੋਲਜ ਹੈਗੇ ਆ ਬਟ ਸੀ ਕੇ ਡੀ ਪ੍ਰੈਫਰਡ ਆ ਬਿਕੋਜ਼ ਉੱਥੇ ਮਤਲਬ ਕਿ ਤੁਹਾਨੂੰ ਨੌਲੇਜ ਵੀ ਬੜੀ ਵਧੀਆ ਏ ਔਰ ਕਾਫੀ ਸਾਰੇ ਸਟਰੀਮਜ ਵੀ ਹੈਗੇ ਆ ਉੱਥੇ ਐਂਡ ਉੱਥੇ ਫੀਸ ਫੀਸ ਵੀ ਬਹੁਤ ਸਾ ਮਤਲਬ ਘੱਟ ਹੈਗੀ ਆ ਐਂਡ ਮਤਲਬ ਕਾਫੀ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਏ ਉੱਥੇ ਅਤੇ ਪ੍ਰਿੰਸੀਪਲ ਵੀ ਬਹੁਤ ਘੈਂਟ ਆ ਹਾਂਜੀ ਹਾਂਜੀ ਜਿਵੇਂ ਗੇਮਸ ਹੋਗੀਆਂ ਕੋਈ ਵੀ ਫੈਸਟੀਵਲ ਹੁੰਦਾ ਏ ਉਹਨੂੰ ਮਤਲਬ ਬਹੁਤ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ ਕੋਈ ਇਤਿਹਾਸਿਕ ਕੋਈ ਪ੍ਰੋਗਰਾਮ ਹੁੰਦਾ ਤਾਂ ਉੱਥੇ ਗੁਰਪੁਰਬ 'ਤੇ ਵੀ ਮਤਲਬ ਪਾਠ ਰੱਖਿਆ ਜਾਂਦਾ ਏ ਬੱਚਿਆਂ ਨੂੰ ਮਤਲਬ ਕਾਫੀ ਜ਼ਿਆਦਾ ਮਤਲਬ ਕਿ ਚੀਜ਼ਾਂ ਸਿਖਾਈਆਂ ਜਾਂਦੀਆਂ ਹਾਂ ਉੱਥੇ ਭੰਗੜੇ ਦੀਆਂ ਕਲਾਸਿਜ਼ ਵੀ ਮਤਲਬ ਸੋਰੀ ਭੰਗੜਾ ਵੀ ਸਿਖਾਇਆ ਜਾਂਦਾ ਓਕੇ ਹਾਂਜੀ ਉੱਥੇ ਬੀਕੌਮ ਸੋਰੀ ਉੱਥੇ ਕਾਫੀ ਸਾਰੇ ਮਤਲਬ ਕੋਰਸਿਸ ਹੈਗੇ ਆ ਬੀ ਐੱਚ ਐੱਮ ਸੀ ਟੀ ਹੈ ਬੀਕੌਮ ਹੈ ਐੱਮ ਬੀ ਹੈ ਐਂਡ ਬੈਚਲਰ ਹੈ ਅਤੇ ਮਤਲਬ ਕਿ ਤੁਸੀਂ ਉੱਥੇ ਅਗਰ ਸੀਨ ਦੇ ਹਿਸਾਬ ਨਾਲ ਤੁਸੀਂ ਉੱਥੇ ਕੰਪਿਊਟਰ ਕਲਾਸਿਸ ਵੀ ਲੱਗ ਜਾਂਦੀਆਂ ਲਾਈਬ੍ਰੇਰੀ ਵੀ ਹੈ ਕੈਨਟੀਨ ਵੀ ਹੈ ਥੈਂਕ ਯੂ